ਮੈਨੂੰ ਕਿਤਾਬਾਂ ਪੜ੍ਹਨਾ ਬਹੁਤ ਜ਼ਿਆਦਾ ਪਸੰਦ ਹੈ ਬਲਕਿ ਮੈਂ ਆਪਣੇ ਫਰੀ ਟਾਈਮ ਵਿੱਚ ਕਿਤਾਬਾਂ ਪੜ੍ਹਦੀ ਰਹਿੰਦੀ ਹਾਂ ਮੈਨੂੰ ਜ਼ਿਆਦਾਤਰ ਸਟੋਰੀ ਬੁੱਕਸ ਪੜ੍ਹਨੀਆ ਪਸੰਦ ਹਨ ਬਲਕਿ ਮੈਨੂੰ ਲੱਗਦਾ ਹੈ ਕਿ ਇੱਕ ਵਧੀਆ ਤਰੀਕਾ ਹੈ ਟਾਈਮ ਪਾਸ ਕਰਨ ਦਾ ਅਤੇ ਇਸ ਦੇ ਨਾਲ ਆਪਣੀ ਨੌਲੇਜ ਵੀ ਵੱਧਦੀ ਹੈ ਮੈਂ ਦੋ ਮਹੀਨੇ ਪਹਿਲਾਂ ਇੱਕ ਕਿਤਾਬ ਪੜ੍ਹੀ ਸੀ ਜਿਸ ਦਾ ਨਾਮ ਸੀ ਹਿਮਾਲੋ ਕੇ ਸੰਤ ਇਹ ਕਿਤਾਬ ਹਿੰਦੀ ਵਿੱਚ ਲਿਖੀ ਹੋਈ ਸੀ ਇਸ ਕਿਤਾਬ ਵਿੱਚ ਬਹੁਤ ਜ਼ਿਆਦਾ ਦ ਕਹਾਣੀਆਂ ਬਾਰੇ ਦੱਸਿਆ ਹੋਇਆ ਸੀ ਅਤੇ ਬਹੁਤ ਜ਼ਿਆਦਾ ਟੋਪਿਕ ਉੱਤੇ ਲਿਖਿਆ ਹੋਇਆ ਸੀ ਮੈਨੂੰ ਜੇ ਮੇਰਾ ਫੇਵਰੇਟ ਟੋਪਿਕ ਇਸ ਬੁੱਕ ਵਿੱਚੋਂ ਇਹ ਸੀ ਕਿ ਆਪਾਂ ਨੂੰ ਮਰਨ ਸਮੇਂ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ ਇਹ ਕਿਤਾਬ ਮੈਂ ਦੋ ਵਾਰ ਪੜ੍ਹੀ ਅਤੇ ਮੈਨੂੰ ਇਹ ਟੋਪਿਕ ਹੀ ਜ਼ਿਆਦਾ ਪਸੰਦ ਆਇਆ ਹੈ ਇਹ ਇਹ ਟੋਪਿਕ ਬਾਰੇ ਮੈਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਦੱਸਿਆ ਅਤੇ ਉਹ ਇਹ ਵੀ ਇਹ ਗੱਲ ਸੁਣ ਕੇ ਬਹੁਤ ਜ਼ਿਆਦਾ ਹੈਰਾਨ ਹੋਏ ਇਸ ਟੋਪਿਕ ਵਿੱਚ ਦੱਸਿਆ ਹੋਇਆ ਸੀ ਕਿ ਜਦੋਂ ਵੀ ਆਪਾਂ ਮਰਦੇ ਹਾਂ ਤਾਂ ਆਪਣੇ ਸੁੱਖ ਦੁੱਖ ਆਪਣੇ ਨਾਲ ਰਹਿੰਦੇ ਹਨ ਬਲਕਿ ਹੋਰ ਕੋਈ ਚੀਜ਼ ਆਪਣੇ ਨਾਲ ਨਹੀਂ ਰਹਿੰਦੀ ਇਹ ਗੱਲ ਮੈਨੂੰ ਬਹੁਤ ਜ਼ਿਆਦਾ ਚੰਗੀ ਲੱਗੀ ਬਲਕਿ ਇਹ ਗੱਲ ਆਪਣੀ ਜ਼ਿੰਦਗੀ ਉੱਤੇ ਵੀ ਨਾਲ ਵੀ ਸੰਬੰਧਿਤ ਹੈ ਕਿਉਂਕਿ ਜਨਮ ਜਨਮ ਮਰਨ ਆਪਣੀ ਜ਼ਿੰਦਗੀ ਵਿੱਚ ਲਿਖਿਆ ਹੋਇਆ ਹੈ ਅਤੇ ਇਹ ਗੱਲ ਮੈਨੂੰ ਇਸ ਕਰਕੇ ਚੰਗੀ ਲੱਗੀ ਕਿਉਂਕਿ ਮਰਨ ਸਮੇਂ ਆਪਾਂ ਨੂੰ ਕਿੱਦਾਂ ਦਾ ਮਹਿਸੂਸ ਹੁੰਦਾ ਇਹ ਗੱਲ ਮੈਂ ਪਹਿਲਾਂ ਹੀ ਪੜ੍ਹ ਚੁੱਕੀ ਹਾਂ ਧੰਨਵਾਦ